ਸਤਿ ਸ਼੍ਰੀ ਅਕਾਲ ਜੀ ਤੁਸੀਂ ਕੱਕੜ ਬੁੱਕ ਹਾਊਸ ਤੋਂ ਗੱਲ ਕਰ ਰਹੇ ਹੋ ਮੈਂ ਤੁਹਾਡੇ ਕੋਲੋਂ ਕੁਛ ਦਿਨ ਪਹਿਲਾਂ ਕਿਤਾਬਾਂ ਮੰਗਵਾਈਆਂ ਸਨ ਆਨਲਾਈਨ ਜਿਹੜੀਆਂ ਕਿ ਬੱਚਿਆਂ ਦੇ ਪੱਧਰ ਦੇ ਅਨੁਸਾਰ ਬਹੁਤ ਠੀਕ ਸਨ ਛਪਾਈ ਵੀ ਬਹੁਤ ਠੀਕ ਸੀਗੀ ਅਤੇ ਬੱਚੇ ਬੜੇ ਖੁਸ਼ ਹੋ ਗਏ ਹਨ ਆਸ ਹੈ ਕਿ ਮੈਂ ਤੁਹਾਡੇ ਕੋਲੋਂ ਹੋਰ ਕਿਤਾਬਾਂ ਮੰਗਵਾਂਵਾ